ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕਿਹੜਾ ਇਲਾਕਾ ਚਾਹੀਦਾ ਤੁਹਾਨੂੰ ਸੌ ਗਜ਼ ਦੀ ਹੋਈ ਚਾਹੀਦੀ ਤੁਹਾਨੂੰ ਅੱਛਾ ਜੀ ਕੋਈ ਗੱਲ ਨਹੀਂ ਸਾਡੇ ਕੋਲ ਦੇਖੋ ਅੱਸੀ ਗਜ਼ ਦੀ ਵੀ ਹੈਗੀ ਹੈ ਦੀ ਵੀ ਹੈਗੀ ਹੈ ਇੱਥੇ ਮੈਡੀਕਲ ਇਨਕਲੇਵ ਦੇ ਲਾਗੇ ਹੀ ਹੈ ਉਹ ਪ੍ਰੋਪਰਟੀ ਆਪਣੀ ਕਹਿ ਲਓ ਕਿ ਆਕਾਸ਼ ਐਵੀਨਿਊ ਅੰਦਰ ਕਰਕੇ ਥੋੜ੍ਹਾ ਪੈਂਦਾ ਉੱਥੇ ਹੈਗੀ ਹੈ ਅਤੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਕੋਈ ਗੱਲ ਨਹੀਂ ਹਾਂਜੀ ਤੁਸੀਂ ਇਸ ਤਰ੍ਹਾਂ ਕਰੋ ਗਿਆਰਾਂ ਵਜੇ ਆਕਾਸ਼ ਐਵੀਨਿਊ ਮੰਦਿਰ ਦੇ ਬਾਹਰ ਨਾ ਸਾਨੂੰ ਮਿਲ ਲਉ ਅਤੇ ਜਿਹੜੀਆਂ ਇੱਕ ਦੋ ਜਗ੍ਹਾ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਫਿਰ ਤੁਸੀਂ ਆਪਣਾ ਕਰ ਲੈਣਾ ਜੋ ਫੈਸਲਾ ਕਰਨਾ ਠੀਕ ਹੈ ਜੀ ਓਕੇ ਜੀ ਮਿਹਰਬਾਨੀ ਜੀ